ਹੈਲੋ ਠੀਕ ਹੈ ਤੁਸੀਂ ਸੁਣਾਓ ਐਨਾ ਦੀਦੀ ਹੋਰ ਬਸ ਠੀਕ ਹੈ ਤੁਸੀਂ ਸੁਣਾਓ ਬਾਕੀ ਘਰ ਸਭ ਹਾਂ ਹਾਂਜੀ ਸਕੂਲ ਮੈਂ ਜਿਹੜੇ ਸਕੂਲ ਆਪਣੇ ਬੱਚੇ ਨੂੰ ਪਾਇਆ ਉਹ ਉਹ ਸਕੂਲ ਵਧੀਆ ਨਹੀਂ ਹੈ ਤੁਸੀਂ ਦੱਸੋ ਕਿ ਤੁਸੀਂ ਕਿੱਥੇ ਪਾਇਆ ਹੈ ਕਿਹੜੇ ਸਕੂਲ ਠੀਕ ਹੈ ਤੁਹਾਡੇ ਬੱਚੇ ਕਿਹੜੇ ਸਕੂਲ ਪੜ੍ਹਦੇ ਅੱਛ ਅੱਛਾ ਅੱਛਾ ਅੱਛਾ ਠੀਕ ਹੈ ਮੈਂ ਦੇਖਾਂਗੀ ਉੱਥੇ ਪਾ ਲਵਾਂਗੀ ਨਹੀ ਤਾਂ ਕਿਉਂਕਿ ਇੱਥੇ ਨਾ ਇਹਦੀ ਪਰਫੋਰਮੰਸ ਥੋੜ੍ਹੀ ਵਧੀਆ ਨਹੀਂ ਆਈ ਇਸ ਲਈ ਹਾਂਜੀ ਕੋਈ ਗੱਲ ਨਹੀਂ ਆਹੋ ਬ ਆਹੋ ਸਕੂਲ ਵਧੀਆ ਅੱਛਾ ਅੱਛਾ ਠੀਕ ਹੈ ਚਲੋ ਦੇਖ ਲਵਾਂਗੀ ਕਿ ਜਿਹੜਾ ਠੀਕ ਲੱਗੇਗਾ ਉੱਥੇ ਪਾ ਦਵਾਂਗੀ ਠੀਕ ਠੀਕ ਹੈ ਓਕੇ ਬਾਏ